ਸਤਿ ਸ਼੍ਰੀ ਅਕਾਲ ਜੀ ਮੈਂ ਬਲਵਿੰਦਰ ਬਿੰਦੂ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਮੈਂ ਪ੍ਰੈੱਸ ਮੰਗਵਾਈ ਸੀ ਪੇ ਪ੍ਰੈਸ ਤਾਂ ਮੈਂ ਕਾਹਦੀ ਮੰਗਵਾ ਲਈ ਆਇਰਨ ਉਹ ਕਾਹਦੀ ਮੰਗਵਾ ਲਈ ਘਰ ਦੇ ਵੀ ਗਾਲਾਂ ਕੱਢਦੇ ਬਾਹਰ ਦੇ ਵੀ ਮੈਨੂੰ ਗਾਲਾਂ ਕੱਢਦੇ ਕਿਉਂਕਿ ਆਡੇ ਗੁਆਂਢੀ ਇੱਦਾਂ ਦੇ ਹੈ ਉਹਨਾਂ ਦੀ ਨਿੱਤ ਬੱਤੀ ਜਿਹੜੀ ਗੁੱਲ ਪ੍ਰੈੱਸ ਮੰਗ ਕੇ ਲੈ ਜਾਂਦੇ ਆ ਅਤੇ ਉਹਨਾਂ ਦੇ ਵਿਚਾਰਿਆਂ ਦੇ ਕੱਪੜੇ ਸਾੜ ਤੇ ਮੇਰੇ ਸੜਦੇ ਸੜਦੇ ਸੀਗੇ ਅਤੇ ਤੁਹਾਡੀ ਪ੍ਰੈੱਸ ਜਿਹੜੀ ਹੈਗੀ ਕਿਸੇ ਕੰਮ ਦੀ ਨਹੀਂ ਹੈਗੀ ਬੱਚੇ ਸ ਸ ਸਕੂਲ ਜਾਣਾ ਹੁੰਦਾ ਅਤੇ ਕਹਿੰਦਾ ਮੰਮਾ ਪ੍ਰੈਸ ਕਰ ਦਿਉ ਮੈਂ ਸਵੇਰੇ ਛੇ ਵਜੇ ਉੱਠ ਕੇ ਜਦੋਂ ਪ੍ਰੈੱਸ ਕਰਦੀ ਹਾਂ ਤਾਂ ਉਹ ਵਿੱਚ ਮੋਰੀਆਂ ਕਰ ਦਿੰਦੀ ਹੈਗੀ ਤੁਹਾਡੀ ਪ੍ਰੈੱਸ ਕਿਸੇ ਵੀ ਕੰਮ ਦੀ ਨਹੀਂ ਹੈਗੀ ਮੈਨੂੰ ਤਾਂ ਬਹੁਤ ਦੁਖੀ ਕੀਤਾ ਹੈ ਹੁਣ ਮੈਂ ਦੱਸੋ ਮੈਂ ਕੰਪਲੇਟ ਕਿੱਥੇ ਕਰਾਂ ਅਤੇ ਤੁਹਾਡੀ ਪ੍ਰੈਸ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਡੇ ਕੋਲ ਕੋਈ ਵੀ ਚੀਜ਼ ਨਹੀਂ ਮੰਗਾਵਾਂਗੀ ਅਤੇ ਨਾ ਹੀ ਮੈਂ ਕਿਸੇ ਨੂੰ ਆਂਡੀਆਂ ਗੁਆਂਢੀਆਂ ਨੂੰ ਮੰਗਵਾਉਣ ਦੇਵਾਂਗੀ ਅਤੇ ਕਿਰਪਾ ਕਰਕੇ ਤੁਸੀਂ ਇਹ ਪ੍ਰੈੱਸ ਜਿਹੜੀ ਹੈਗੀ ਵੇਚਣੀ ਛੱਡ ਦਿਉ ਤਾਂ ਜੋ ਸਮਾਜ ਦਾ ਜਿਹੜਾ ਭਲਾ ਹੋ ਸਕੇਗਾ